ਖੇਤੀਬਾੜੀ ਦਾ ਉੱਦਮ ਸ਼ੁਰੂ ਕੀਤਾ ਹੈਗਾ ਪਰ ਟਿਊਬਲ ਵੀ ਲਗਵਾਇਆ ਉੱਪਰੋਂ ਪਾਣੀ ਬਿਜਲੀ ਦਾ ਕਨੈਕਸ਼ਨ ਨਹੀਂ ਮਿਲ ਰਿਹਾ ਬਿਜਲੀ ਦਫਤਰ ਜਾਂਦੇ ਹਾਂ ਅੱਜ ਨਹੀਂ ਤਾਂ ਕੱਲ੍ਹ ਹੋ ਜਾਊ ਕੰਮ ਕੱਲ੍ਹ ਨਹੀਂ ਤਾਂ ਪਰਸੋਂ ਹੋ ਜਾਊ ਡੇਟ 'ਤੇ ਡੇਟ ਦਈ ਜਾਂਦੇ ਨੇ ਕੀ ਕਰੀਏ ਬਿਜਲੀ ਲਗਵਾ ਕੇ ਵੀ ਕਿੱਥੇ ਕੁਝ ਫਾਇਦਾ ਨਹੀਂ ਹੋ ਰਿਹਾ ਟਿਊਬਲ ਲਗਵਾਇਆ ਉਹ ਲਾਈਟ ਨਹੀਂ ਹੋਏਗੀ ਤਾਂ ਚੱਲੇਗਾ ਕਿੱਥੋਂ ਉੱਪਰੋਂ ਕਣਕ ਦੀ ਬਿਜਾਈ ਦਾ ਟਾਈਮ ਆਈ ਜਾਂਦਾ ਕਿੰਨੀਆਂ ਪਰੇਸ਼ਾਨੀਆਂ ਨੇ ਜਿਮੀਦਾਰ ਨੂੰ ਜੇ ਜਿਮੀਦਾਰ ਟਾਈਮ 'ਤੇ ਬੀਜੇਗਾ ਨਹੀਂ ਤਾਂ ਖਾਏਗਾ ਕੀ ਖਾਏਗਾ ਕੀ ਅਤੇ ਨਿਚੋੜੇਗਾ ਕੀ ਕਹਿੰਦੇ ਉਹ ਨੰਗਾ ਕਹਾਵਤਾਂ ਬੜੀਆਂ ਬਣੀਆਂ ਹੋਈਆਂ ਨੇ ਤੁਸੀਂ ਬੜੇ ਪਰੇਸ਼ਾਨ ਹੋ ਗਏ ਅਸੀ ਤਾਂ ਪੈਸੇ ਵੀ ਵੇਸਟ ਕਰ ਬੈਠੇ ਹਾਂ ਜ਼ਮੀਨ ਲੈ ਕੇ ਅਤੇ ਟਿਊਬਲ ਵੀ ਲਗਵਾਇਆ ਉਪਰੋਂ ਕੋਈ ਕੁਨੈਕਸ਼ਨ ਹੈ ਨਹੀਂ ਕੋਈ ਪਾਣੀ ਦਾ ਸਾਧਨ ਹੈ ਨਹੀਂ ਜਲ ਵਿਭਾਗ ਵਾਲੇ ਵੀ ਜਾ ਬੈਠੇ ਆ ਉਹ ਵੀ ਕਹਿੰਦੇ ਥੋੜ੍ਹਾ ਟਾਈਮ ਲੱਗੇਗਾ ਥੋੜ੍ਹਾ ਟਾਈਮ ਲੱਗੇਗਾ ਟਾਈਮ ਟਾਈਮ ਕਰਦੇ ਕਰਦੇ ਟਾਈਮ ਆ ਗਿਆ ਅਪ੍ਰੈਲ ਮਹੀਨਾ ਚੜ੍ਹ ਗਿਆ